ਹਾਂਜੀ ਟੈਕਨੋਲੋਜੀ ਦਾ ਅਧਿਐਨ ਕਰਨ ਦੇ ਲਈ ਇਹ ਇੱਕ ਬੁਨਿਆਦੀ ਵਿਸ਼ਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਣੀ ਬੇਸਿਕ ਟੈਕਨੋਲੋਜੀ ਕੰਪਿਊਟਰ ਹੀ ਆਏ ਸੀਗੇ ਤਾਂ ਉਹ ਵੀ ਆਪਾਂ ਨੂੰ ਸਕੂਲਾਂ ਦੇ ਵਿੱਚ ਇੱਕ ਵਿਸ਼ੇ ਦੇ ਵਜੋਂ ਲਗਾਏ ਗਏ ਸੀਗੇ ਤਾਂ ਕਿ ਬੱਚਿਆਂ ਨੂੰ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਕਿ ਕਿਵੇਂ ਉਹ ਕੰਪਿਊਟਰਾਂ ਦੀ ਵਰਤੋਂ ਕਰ ਸਕਦੇ ਨੇ ਜਿਵੇਂ ਹੁਣ ਆਪਾਂ ਪਿਛਲੇ ਦੋ ਤਿੰਨ ਸਾਲਾਂ ਦੀ ਗੱਲ ਕਰੀਏ ਕਿ ਆਪਾਂ ਕਰੋਨਾ ਕਾਲ ਵੇਖਿਆ ਹੈ ਜਿਹਦੇ ਵਿੱਚ ਕਿ ਆਪਾਂ ਦੇਖਿਆ ਕਿ ਜ਼ਿੰਦਗੀ ਹੈ ਜਿਹੜੀ ਉਹ ਕਾਫੀ ਰੁਕ ਗਈ ਸੀਗੀ ਪਰ ਆਪਣੀਆਂ ਜਿਹੜੀਆਂ ਜ਼ਰੂਰਤਾਂ ਸੀਗੀਆਂ ਉਹ ਆਪਾਂ ਕੀ ਕੀਹਦੀ ਮਦਦ ਦੇ ਨਾਲ ਪੂਰੀਆਂ ਕੀਤੀਆਂ ਟੈਕਨੋਲੋਜੀ ਦੀ ਮਦਦ ਦੇ ਨਾਲ ਜੇ ਸਾਨੂੰ ਉਹ ਟੈਕਨੋਲੋਜੀ ਦਾ ਗਿਆਨ ਹੀ ਨਹੀਂ ਹੋਊਗਾ ਤਾਂ ਅਸੀਂ ਆਪਣੀਆਂ ਇੱਦਾਂ ਦੀਆਂ ਜ਼ਰੂਰਤਾਂ ਇੱਦਾਂ ਦੇ ਕਾ ਕਾਲ ਦੇ ਵਿੱਚ ਆ ਜਿਹੜਾ ਉਹ ਨਹੀਂ ਸਰਵਾਈਵ ਕਰ ਸਕਦੇ ਹੈਗੇ ਸੋ ਇਹਨਾਂ ਟੈਕਨੋਲੋਜੀਸ ਦਾ ਇੱਕ ਬੁਨਿਆਦੀ ਵਿਸ਼ਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਅ ਬਹੁਤ ਵੱਡੀ ਐਗਜ਼ਾਮਪਲ ਹੈ ਜਿਹੜੀ ਸਾਡੀ ਕਰੋਨਾ ਕਾਲ ਸੋ ਆਪਾਂ ਨੂੰ ਜੇ ਇਹ ਵਿਸ਼ਾ ਪਹਿਲਾਂ ਹੀ ਪੜ੍ਹਾਇਆ ਜਾਊਗਾ ਤਾਂ ਹੀ ਅਸੀਂ ਉਸ ਬੇਸਿਕ ਨੋਲੇਜ ਨੂੰ ਲੈ ਕੇ ਹੈ ਜਿਹੜਾ ਅੱਗੇ ਜਿਹੜੀਆਂ ਅਪਡੇਸ਼ਨਸ ਜਿਹੜੀਆਂ ਅੱਗੇ ਚੇਂਜਿਸ ਆਉਣੀਆਂ ਨੇ ਟੈਕਨੋਲੋਜੀ ਦੀਆਂ ਤਾਂ ਹੀ ਉਹ ਚੀਜ਼ਾਂ ਨੇ ਜਿਹੜੀਆਂ ਉਹ ਅਸੀਂ ਸਿੱਖ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਅਗਲਾ ਜੀਵਨ ਹੈ ਜਿਹੜਾ ਸਾਡਾ ਉਹ ਜ਼ਿਆਦਾਤਰ ਟੈੋਕਨਾਲੋਜੀ ਦੇ ਵਿੱਚ ਹੀ ਹੈ ਜਿਹੜਾ ਉਹ ਨਿਕਲਣਾ ਹੈ ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਮੁੱਢਲਾ ਗਿਆਨ ਹੋਊਗਾ ਤਾਂ ਹੀ ਅਸੀਂ ਟੈਕਨੋਲੋਜੀ ਦੇ ਵਿੱਚ ਦਿੱਤੀਆਂ ਗਈਆਂ ਨਵੀਆਂ ਖੋਜਾਂ ਖੋਜਾਂ ਨੂੰ ਹੈ ਜਿਹੜਾ ਜਾਂ ਖੋਜਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜਾਂ ਫਿਰ ਉਹਨਾਂ ਨਵੀਆਂ ਖੋਜਾਂ ਦੇ ਮਦਦ ਦੀ ਮਦਦ ਦੇ ਨਾਲ ਹੀ ਹੈ ਆਪਣੇ ਕੰਮ ਕਾਰ ਜਿਹੜੇ ਉਹ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਇਹ ਇੱਕ ਬੁਨਿਆਦੀ ਵਿਸ਼ਾ ਹੈ ਜਿਹੜਾ ਉਹ ਜ਼ਰੂਰ ਲਾਉਣਾ ਚਾਹੀਦਾ ਚਾਹੇ ਉਹ ਸਕੂਲਾਂ ਕੋਲਜਾਂ ਦੇ ਵਿੱਚ ਹੋਵੇ ਜਾਂ ਫਿਰ ਕਹਿ ਲਉ ਕਿਸੇ ਹੋਰ ਸੈਕਟਰ ਦੇ ਵਿੱਚ ਜਿਹੜੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ